ਜੀ ਬਿਲਕੁਲ ਸਕੂਲ ਟਾਈਮ 'ਤੇ ਮੈਨੂੰ ਲੱਗਦਾ ਹੈ ਕਿ ਮੈਂ ਨੌਵੀਂ ਕਲਾਸ 'ਚ ਹੋਵਾਂਗੀ ਉਦੋਂ ਸਾਡੀ ਸਾਇੰਸ ਦੀ ਮੈਡਮ ਨੇ ਕਿਹਾ ਕਿ ਤੁਸੀਂ ਕੁਛ ਬੱਚੇ ਨਾ ਕੋਈ ਪ੍ਰੋਜੈਕਟ ਬਣਾਓ ਉਸ ਟਾਈਮ 'ਤੇ ਸਾਡੇ ਟਾਈਮ 'ਤੇ ਨਾ ਬੜਾ ਕੋਮਨ ਹੈਗਾ ਸੀ ਸੋਲਰ ਕੁੱਕਰ ਸਾਡੀ ਚਾਰ ਕਹਿ ਲਉ ਕਿ ਸਟੂਡੈਂਟਸ ਦੀ ਇੱਕ ਟੀਮ ਸੀ ਚਾਰ ਅਸੀਂ ਫਰੈਂਡ ਸੀ ਸਾਨੂੰ ਸਾਰਿਆਂ ਨੂੰ ਮਤਲਬ ਇਹੋ ਜਿਹੇ ਪ੍ਰੋਜੈਕਟਾਂ ਦਾ ਬੜਾ ਸ਼ੌਕ ਸੀ ਅਤੇ ਸਾਡੀ ਟੀਚਰ ਨੇ ਸਾਨੂੰ ਪ੍ਰੋਜੈਕਟ ਦਿੱਤਾ ਅਸੀਂ ਵੀ ਉਹਦੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਦੋਂ ਤੁਹਾਨੂੰ ਪਤਾ ਹੈ ਕਿ ਦਸ ਦਸ ਰੁਪਏ ਅਸੀਂ ਘਰੋਂ ਲਿਆਂਦੇ ਥੋੜ੍ਹਾ ਥੋੜ੍ਹਾ ਸਮਾਨ ਇਕੱਠਾ ਕੀਤਾ ਕਿਸੇ ਨੇ ਕੁਛ ਲਿਆਂਦਾ ਕਿਸੇ ਨੇ ਕੁਛ ਲਿਆਂਦਾ ਅਤੇ ਅਸੀਂ ਸੋਲਰ ਕੁੱਕਰ ਬਣਾਇਆ ਉਹ ਸੋਲਰ ਕੁੱਕਰ ਜਦੋਂ ਅਸੀਂ ਆਪਣੀ ਮੈਡਮ ਨੂੰ ਦਿਖਾਇਆ ਉਹਨਾਂ ਨੂੰ ਵਾਕਈ ਬੜਾ ਪਸੰਦ ਆਇਆ ਉਹ ਵੀ ਦੇਖ ਕੇ ਹੈਰਾਨ ਸੀ ਅਸੀਂ ਆਪਣੇ ਆਪ 'ਚ ਵੀ ਇੰਨੇ ਹੈਰਾਨ ਸੀ ਕਿ ਅਸੀਂ ਇੰਨਾ ਵਧੀਆ ਸੋਲਰ ਕੁੱਕਰ ਕਿਵੇਂ ਬਣਾ ਲਿਆ ਜਦੋਂ ਉਹਨੂੰ ਇਸਤੇਮਾਲ ਕੀਤਾ ਗਿਆ ਤਾਂ ਸੱਚ ਪੁੱਛੋ ਕਿ ਅਸੀਂ ਆਪ ਹੀ ਹੈਰਾਨ ਹੋ ਗਏ ਕਿ ਇਹ ਸੋਲਰ ਕੁੱਕਰ ਗੈਸ ਤੋਂ ਵੀ ਵਧੀਆ ਕੰਮ ਕਰ ਰਿਹਾ ਅਤੇ ਇੱਕ ਪ੍ਰਾਕ੍ਰਿਤੀ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸੂਰਜ ਨਾਲ ਚੱਲ ਰਿਹਾ ਅਸੀਂ ਖੁਦ ਦੇਖ ਕੇ ਹੈਰਾਨ ਸੀ ਉਹ ਅਨੁਭਵ ਕਹਿ ਲਓ ਕਿ ਇਹੋ ਜਿਹਾ ਸੀ ਨਾ ਇੰਨਾ ਵਧੀਆ ਸੀ ਕਿ ਅੱਜ ਵੀ ਯਾਦ ਆਉਂਦਾ ਮੈਂ ਆਪਣੇ ਬੱਚਿਆਂ ਨੂੰ ਵੀ ਇਸਦੇ ਬਾਰੇ ਬਹੁਤ ਵਾਰੀ ਦੱਸਿਆ